ਸਤਾਈ ਮਾਰਚ ਉੱਨੀ ਸੌ ਇਕਿਆਸੀ ਅਠਾਈ ਮਾਰਚ ਦੋ ਹਜ਼ਾਰ ਪੰਜ ਚੌਦਾਂ ਮਾਰਚ ਦੋ ਹਜ਼ਾਰ ਇੱਕੀ ਅਠਾਈ ਅਗਸਤ ਉੱਨੀ ਸੌ ਅੱਸੀ ਬਾਈ ਮਾਰਚ ਉੱਨੀ ਸੌ ਬਿਆਸੀ